ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਸੋਚਿਆ ਤਾਂ ਸੀ ਫਸਟ ਔਫ ਔਲ ਮੇਰੀ ਤਾਂ ਪ੍ਰੈਫਰੈਂਸ ਆ ਕਿ ਜੇ ਸਕੂਲ 'ਚ ਹੁਣ ਸਾਡੇ ਬੱਚੇ ਜਾਣ ਮਤਲਬ ਅੱਛਾ ਮਾਹੌਲ ਹੋਵੇ ਅੱਛੀਆਂ ਫੈਸਲਟੀਜ ਹੋਣ ਅੱਛੇ ਟੀਚਰਜ਼ ਐਵਰੀਥਿੰਗ ਮਤਲਬ ਇੱਦਾਂ ਦਾ ਹੋਵੇ ਕਿ ਉਹਨਾਂ ਨੂੰ ਅੱਗੇ ਆਉਣ ਵਾਲੇ ਹਰ ਕੋਂਪੀਟੀਸ਼ਨ ਲਈ ਤਿਆਰ ਕਰੇ ਔਰ ਜੇ ਤੁਹਾਡੇ ਕੋਲ ਕਿਸੇ ਸਕੂਲ ਦਾ ਕੋਈ ਸੁਜੈਸ਼ਨ ਆ ਤਾਂ ਤੁਸੀਂ ਪਲੀਜ਼ ਮੇਰੇ ਨਾਲ ਸ਼ੇਅਰ ਕਰ ਸਕਦੇ ਓਂ ਹਾਂਜੀ ਉਹ ਸਕੂਲ ਬਹੁਤ ਅੱਛਾ ਬਟ ਮੈਨੂੰ ਲੱਗਦਾ ਉੱਥੇ ਫੀਸ ਥੋੜ੍ਹੀ ਜ਼ਿਆਦਾ ਨਹੀਂ ਹੈ ਔਰ ਟੀਚਰਸ ਦੇ ਅਕੋਰਡਿੰਗ ਤੁਹਾਡਾ ਕੀ ਮਤਲਬ ਹੈਗਾ ਨਜ਼ਰੀਆ ਅਤੇ ਉਹਨਾਂ ਦੀ ਮੈਕਸੀਮਮ ਮਤਲਬ ਕਿ ਉੱਨੀ ਇੱਕੀ ਮਤਲਬ ਉਹਨਾਂ ਦੀ ਮੈਕਸੀਮਮ ਕੀ ਹੈਗੀ ਹੈ ਰਿਕੁਆਇਰਮੈਂਟ ਟੀਚਰਸ ਨੂੰ ਹਾਇਰ ਕਰਨ ਦੀ ਇਹ ਮਤਲਬ ਮੈਂ ਚਾਹੁੰਦੀ ਹਾਂ ਕਿ ਜਿਹੜੇ ਟੀਚਰ ਸਾਡੇ ਬੱਚਿਆਂ ਨੂੰ ਸਿਖਾਉਣ ਓਹ ਖੁਦ ਵੀ ਅੱਛੇ ਵੈੱਲ ਐਡੂਕੇਟਿਡ ਹੋਣ ਅਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਫਿਰ ਐਜੂਕੇਸ਼ਨ ਓਕੇ ਥੈਂਕ ਯੂ